ਰੋਪੜ ਜ਼ਿਲ੍ਹੇ ਵਿੱਚ ਸੜਕਾਂ ਦਾ ਹੁਣ ਤਾਂ ਬਹੁਤ ਜ਼ਿਆਦਾ ਪ੍ਰਬੰਧ ਹੈ ਜਿਵੇਂ ਕਿ ਪਹਿਲਾਂ ਤਾਂ ਜਿਵੇਂ ਪਹਿਲੀ ਸਰਕਾਰ ਸੀਗੀ ਉਸ ਟਾਈਮ ਤਾਂ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਹੁੰਦੀਆਂ ਸੀਗੀਆਂ ਜਿਵੇਂ ਪਿੰਡਾਂ ਦੇ ਲਿੰਕ ਰੋਡ ਸੀਗੇ ਉਹ ਵੀ ਜ਼ਿਆਦਾ ਟੁੱਟੇ ਹੋਏ ਮਿਲਦੇ ਸੀਗੇ ਜਦੋਂ ਅੱਜ ਕੱਲ੍ਹ ਦੇਖਦੇ ਹਾਂ ਆਪਾਂ ਅੱਜ ਕੱਲ੍ਹ ਪਿੰਡਾਂ ਦੇ ਰੋਡ ਵੀ ਸਾਫ ਸੁਥਰੇ ਅਤੇ ਬਣੇ ਹੋਏ ਨੇ ਅਤੇ ਗੱਲ ਕਰੀਏ ਮੇਨ ਹਾਈਵਿਆਂ ਦੀ ਤਾਂ ਹਾਈਵੇਅ ਬਹੁਤ ਜ਼ਿਆਦਾ ਚੌੜੇ ਹੋ ਚੁੱਕੇ ਨੇ ਜਿਹਨਾਂ ਕਰਕੇ ਟਰੈਫਿਕ ਬਹੁਤ ਘੱਟ ਗਈ ਹੈ ਅਤੇ ਬਾਈਪਾਸ ਨਿਕਲ ਗਿਆ ਜਿਸ ਨਾਲ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਟਰੈਫਿਕ ਦਾ ਕੰਟਰੋਲ ਹੋ ਚੁੱਕਾ